ਟਕਨੋਲਜੀ ਨੇ ਸਾਡੇ ਜੀਵਨ ਵਿੱਚ ਬਹੁਤ ਸਾਰੇ ਬਦਲਾਅ ਕੀਤੇ ਹਨ ਇੱਕ ਤਰ੍ਹਾਂ ਨਾਲ ਸਾਡੀ ਜ਼ਿੰਦਗੀ ਨੂੰ ਬਦਲ ਕੇ ਹੀ ਰੱਖ ਦਿੱਤਾ ਹੈ ਟਕਨੋਲਜੀ ਦੇ ਕਾਰਨ ਅੱਜ ਕੱਲ੍ਹ ਅਸੀਂ ਸਮਾਰਟਫੋਨ ਦੀ ਵਰਤੋਂ ਕਰਦੇ ਹੈ ਜਿਸ ਰਾਹੀਂ ਅਸੀਂ ਸਾਨੂੰ ਮੈਸੇਜ ਕਰਨਾ ਵਟਸਐਪ ਚਲਾਉਣਾ ਫੇਸਫੁੱਕ ਚਲਾਉਣੀ ਬਹੁਤ ਸਾਰੀਆਂ ਹੋਰ ਐਂਟਰਨੈਟ 'ਤੇ ਚੀਜ਼ਾਂ ਉਪਲੱਬਧ ਨੇ ਜਿਹੜੀਆਂ ਸਾਡੀ ਜ਼ਿੰਦਗੀ ਨੂੰ ਬਹੁਤ ਅਸਾਨ ਬਣਾਉਂਦੀਆਂ ਹਨ ਟਕਨੋਲਜੀ ਨੇ ਸਾਡੀਆਂ ਦੂਰੀਆਂ ਨੂੰ ਨਜ਼ਦੀਕ ਕਰ ਦਿੱਤਾ ਹੈ ਤਕਨੋਲਜੀ ਦੇ ਕਾਰਨ ਹੀ ਅੱਜ ਅਸੀਂ ਬਹੁਤ ਸਾਰੀਆਂ ਖੋਜਾਂ ਕਰ ਰਹੇ ਹੈ ਅੱਗੇ ਵੱਧ ਰਹੇ ਹੈ ਟਕਨੋਲਜੀ ਦੇ ਨਾਲ ਹੀ ਅਸੀਂ ਸੰਸਾਰ ਦੇ ਵਿੱਚ ਆਪਣੀ ਅਲੱਗ ਪਹਿਚਾਣ ਬਣਾ ਰਹੇ ਹਾਂ ਟਕਨੋਲਜੀ ਦੀ ਵਰਤੋਂ ਨਾਲ ਅਸੀਂ ਰਾਸ਼ਟਰੀ ਅੰਤਰਰਾਸ਼ਟਰੀ ਪੱਧਰ 'ਤੇ ਆਪਣੀ ਕਾਇਮ ਸ਼ਾਪ ਕਰ ਰਹੇ ਹਾਂ ਤਕਨੋਲਜੀ ਦੇ ਨਾਲ ਅਸੀਂ ਬਹੁਤ ਸਾਰੀਆਂ ਬੈਂਕਿੰਗ ਸੁਵਿਧਾਵਾਂ ਭੁਗਤਾਨ ਖ਼ਰੀਦਦਾਰੀ ਚੀਜ਼ਾਂ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹਾਂ ਤਕਨੋਲਜੀ ਦੇ ਨਾਲ ਅਸੀਂ ਚੀਜ਼ਾਂ ਬਾਰੇ ਜਾਣਕਾਰੀ ਹੀ ਪ੍ਰਾਪਤ ਨਹੀਂ ਕਰਦੇ ਉਹਨਾਂ ਨੂੰ ਅਸੀਂ ਖ਼ਰੀਦਦੇ ਵੀ ਹਾਂ ਜਿੱਦਾਂ ਕਿ ਅਸੀਂ ਹੋਟਲ ਬੁੱਕ ਕਰਨਾ ਬੱਸ ਦੀ ਟਿਕਟ ਬੁਕਿੰਗ ਕਰਨੀ ਇਸ ਤਰ੍ਹਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਗਤੀਵਿਧੀਆਂ ਅਸੀਂ ਐਟਰਨੈੱਟ ਰਾਹੀਂ ਕਰਦੇ ਹਾਂ ਬੈਂਕਿੰਗ ਵਿੱਚ ਅਸੀਂ ਟਰਾਂਜੈਕਸ਼ਨਾਂ ਕਰਦੇ ਹਾਂ ਉਹ ਵੀ ਅਸੀਂ ਟਕਨੋਲਜੀ ਦੇ ਨਾਲ ਹੀ ਕਰਦੇ ਹਾਂ